ਜੇਕਰ ਸਿਹਤ ਸੰਭਾਲ ਬੀਮਾ ਦੀ ਗੱਲ ਕੀਤੀ ਜਾਵੇ ਤਾਂ ਮੇਰੇ ਕੋਲ ਹਾਲੇ ਤੱਕ ਇੱਦਾਂ ਦਾ ਕੋਈ ਬੀਮਾ ਨਹੀਂ ਹੈ ਪ੍ਰੰਤੂ ਮੇਰੇ ਪਿਤਾ ਜੀ ਕੋਲ ਇੱਦਾਂ ਦਾ ਇੱਕ ਐੱਲ ਆਈ ਸੀ ਦਾ ਬੀਮਾ ਹੈ ਜੋ ਜਿਸ ਵਿੱਚ ਕਿ ਪੰਜ ਲੱਖ ਤੱਕ ਦੇ ਸ ਸਾਡਾ ਫਰੀ ਇਲਾਜ ਹੋ ਸਕਦਾ ਹੈ ਜਿਵੇਂ ਕਿ ਰਜਿਸਟਰਡ ਹੋਸਪਿਟਲਜ਼ ਦੇ ਵਿੱਚ ਹੀ ਅਸੀਂ ਇਲਾਜ ਕਰਵਾ ਸਕਦੇ ਹਾਂ ਅਤੇ ਉਹ ਪੈਸਾ ਜੋ ਵੀ ਹੋਏਗਾ ਉਹ ਕੰਪਨੀ ਵੱਲੋਂ ਹੀ ਦਿੱਤਾ ਜਾਏਗਾ ਮੈਨੂੰ ਇਹਨਾਂ ਚੀਜ਼ਾਂ ਬਾਰੇ ਬਸ ਐਨੀ ਹੀ ਜਾਣਕਾਰੀ ਸੀ